ਹੈਲੋ ਸਰ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਕੰਪਨੀ ਮੀਸ਼ੋ ਤੋਂ ਵਾਸ਼ਿੰਗ ਮਸ਼ੀਨ ਮੰਗਵਾਈ ਸੀ ਪਹਿਲਾਂ ਤਾਂ ਜੋ ਰੰਗ ਮੰਗਵਾਇਆ ਸੀ ਉਹ ਨਹੀਂ ਮਿਲਿਆ ਦੂਸਰਾ ਜਦੋਂ ਮੈਂ ਇਸ ਮਸ਼ੀਨ 'ਚ ਕੱਪੜੇ ਪਾ ਕੇ ਧੋਤੇ ਤਾਂ ਇਸਨੇ ਪੈਂਟਾਂ ਦੇ ਹੁੱਕਾਂ ਅਤੇ ਕਮੀਜ਼ਾਂ ਦੇ ਬਟਨ ਤੋੜ ਦਿੱਤੇ ਅਤੇ ਦੂਸਰਾ ਇਸ ਨੇ ਕੱਪੜਿਆਂ ਦੀ ਚੰਗੀ ਤਰ੍ਹਾਂ ਸਫ਼ਾਈ ਨਹੀਂ ਕੀਤੀ ਕੱਪੜਿਆਂ 'ਤੇ ਜੋ ਦਾਗ਼ ਲੱਗੇ ਸੀ ਉਹ ਲੱਗੇ ਰਹਿ ਗਏ ਇਸ ਮਸ਼ੀਨ ਨੇ ਕੱਪੜੇ ਵੀ ਪਾੜ ਦਿੱਤੇ ਮੈਂ ਤੁਹਾਡੇ ਵੱਲੋਂ ਭੇਜੀ ਗਈ ਇਸ ਮਸ਼ੀਨ ਨਾਲ ਬਿਲਕੁਲ ਵੀ ਸੇਟੀਸਫਾਏ ਨਹੀਂ ਹਾਂ ਇਸ ਮਸ਼ੀਨ 'ਚ ਜਦੋਂ ਮੈਂ ਕੱਪੜੇ ਕੱਢਣ ਲੱਗੀ ਤਾਂ ਇਸ ਨੇ ਕਰੰਟ ਵੀ ਮਾਰਿਆ ਇਹ ਵਾਸ਼ਿੰਗ ਮਸ਼ੀਨ ਬਹੁਤ ਹੀ ਘਟੀਆ ਕੁਆਲਟੀ ਦੀ ਹੈ ਮੈਂ ਇਸ ਮਸ਼ੀਨ ਤੋਂ ਬਿਲਕੁਲ ਵੀ ਖੁਸ਼ ਨਹੀਂ ਹਾਂ